ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਬਾਰੇ ਤਾਂ ਗੱਲ ਹੀ ਕੀ ਕੀਤੀ ਜਾਵੇ ਪੰਜਾਬੀ ਭਾਸ਼ਾ ਅੱਜ ਕੱਲ੍ਹ ਇੰਨੀ ਮਸ਼ਹੂਰ ਹੋ ਚੁੱਕੀ ਹੈ ਪੰਜਾਬੀ ਪੰਜਾਬੀ ਭਾਸ਼ਾ ਐਨੀ ਐਨੀ ਕਿ ਪੁੱਛੋ ਹੀ ਨਾ ਹਰੇਕ ਕਿਤੇ ਪੰਜਾਬੀ ਚੱਲ ਰਹੀ ਹੈ ਘਰੇ ਪੰਜਾਬੀ ਟੈਲੀਵਿਜ਼ਨ 'ਚ ਪੰਜਾਬੀ ਦੇ ਇੰਨੇ ਚੈਨਲ ਨੇ ਅਖਬਾਰ ਪੰਜਾਬੀ 'ਚ ਆਉਂਦੇ ਨੇ ਸਕੂਲਾਂ 'ਚ ਵੀ ਇੱਥੋਂ ਤੱਕ ਕਿ ਪੰਜਾਬੀ ਲਾਗੂ ਕੀਤੀ ਗਈ ਹੈ ਕਿ ਹਰੇਕ ਕੰਮ ਪੰਜਾਬੀ ਵਿੱਚ ਕੀਤਾ ਜਾਵੇ ਅੱਜ ਕੱਲ੍ਹ ਤੁਸੀਂ ਗੂਗਲ 'ਤੇ ਵੀ ਪੰਜਾਬੀ ਕਰ ਸਕਦੇ ਹੋ ਸਰਚ ਮਾਰੋ ਗੂਗਲ ਤੁਹਾਨੂੰ ਨਾਲ ਦੀ ਨਾਲ ਪੰਜਾਬੀ 'ਚ ਦੱਸ ਦਏਗਾ ਅੱਜ ਕੱਲ੍ਹ ਤੁਸੀਂ ਪੰਜਾਬੀ ਦਾ ਕਿਤੋਂ ਵੀ ਪਰਸ ਕਿਤੇ ਵੀ ਜਾਓ ਹਰੇਕ ਥਾਂ 'ਤੇ ਪੰਜਾਬੀ ਅੱਜ ਕੱਲ੍ਹ ਰੋਡ 'ਤੇ ਵੇਖੋ ਜਿੱਥੇ ਮਰਜ਼ੀ ਦੇਖ ਲਓ ਹਰੇਕ ਥਾਂ 'ਤੇ ਪੰਜਾਬੀ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਰੋੜਾਂ 'ਤੇ ਵੀ ਉਹ ਵੀ ਪੰਜਾਬੀ 'ਚ ਲਿਖੇ ਜਾਂਦੇ ਆ ਵੀ ਪੰਜਾਬੀ 'ਚ ਸੱਜੇ ਪਾਸੇ ਚੱਲੋ ਖੱਬੇ ਪਾਸੇ ਚੱਲੋ ਹਰੇਕ ਥਾਂ ਜਗ੍ਹਾ 'ਤੇ ਪੰਜਾਬੀ ਲਾਗੂ ਕੀਤੀ ਜਾ ਰਹੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਐਨੀ ਹੋ ਚੁੱਕੀ ਹੈ ਅੱਜ ਕੱਲ੍ਹ ਪੰਜਾਬੀ ਭਾਸ਼ਾ ਨੂੰ ਦੱਸੋ ਹੀ ਮੱਤ ਪੰਜਾਬੀ ਭਾਸ਼ਾ ਹਰੇਕ ਥਾਂ 'ਤੇ ਮੌਜੂਦ ਆ ਹਰੇਕ ਥਾਂ 'ਤੇ ਪੰਜਾਬੀ ਹਰੇਕ ਥਾਂ 'ਤੇ ਪੰਜਾਬੀ ਪ੍ਰਿੰਟ ਆਊਟ ਵੀ ਤੁਸੀਂ ਪੰਜਾਬੀ 'ਚ ਕਢਾ ਸਕਦੇ ਹੋ ਅੱਜ ਕੱਲ੍ਹ ਤੁਸੀਂ ਪ੍ਰਿੰਟ ਆਊਟ ਕਢਾਉਣਾ ਉਹ ਵੀ ਪੰਜਾਬੀ 'ਚ ਹੋ ਸਕਦਾ ਪੰਜਾਬੀ 'ਚ ਇਹਨੂੰ ਇੱਥੋਂ ਤੱਕ ਕਿ ਪੰਜਾਬੀ ਨੂੰ ਮਾਂ ਬੋਲੀ ਦੀ ਪੰਜਾਬੀ ਕਿਹਾ ਗਿਆ ਹੈ ਇਹਨੂੰ ਜੋ ਕਿ ਬੱਚਾ ਮਾਂ ਦੀ ਕੁੱਖ ਤੋਂ ਹੀ ਸਿੱਖ ਕੇ ਆਉਂਦਾ ਪੰਜਾਬੀ ਅੱਜ ਕੱਲ੍ਹ ਪੰਜਾਬੀ ਇੰਨੀ ਸਕੂਲਾਂ 'ਚ ਨਹੀਂ ਹੈ ਜਿੰਨੀ ਮਾਂ ਦੀ ਕੁੱਖ 'ਚੋਂ ਪੰਜਾਬੀ ਬੋਲੀ ਜਾਂਦੀ ਅੱਜ ਕੱਲ੍ਹ ਪੰਜਾਬੀ ਨੂੰ ਐਨਾ ਦਿੱਤਾ ਗਿਆ ਐਨਾ ਦਿੱਤਾ ਗਿਆ ਪੰਜਾਬੀ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ ਪੰਜਾਬੀ ਨੂੰ